ਸਾਡੇ ਪੇਂਡੂ ਖੇਤਰ ਵਿੱਚ ਬਹੁਤ ਸਾਰੇ ਸਕੂਲ ਅਤੇ ਕਾਲਜ ਖੋਲ੍ਹੇ ਗਏ ਹਨ ਜਿਨ੍ਹਾ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ ਨਾਲ ਦੀ ਨਾਲ ਉਹਨਾਂ ਨੂੰ ਰੁਜ਼ਗਾਰ ਦੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਇਹਨਾਂ ਕਾਲਜਾਂ ਵਿੱਚ ਸਟੈਮ ਫੀਲਡ ਪ੍ਰੋਗਰਾਮਾਂ ਅਤੇ ਕੋਰਸ ਵੀ ਕਰਵਾਏ ਜਾਂਦੇ ਹਨ ਇਹਨਾਂ ਤੋਂ ਉਹਨਾਂ ਨੂੰ ਰੁਜ਼ਗਾਰ ਵੀ ਦਿੱਤੇ ਜਾਂਦੇ ਹਨ ਸਾਇੰਸ ਵਿੱਚ ਜਿਵੇਂ ਬੱਚੇ ਨੇ ਨਰਸਿੰਗ ਕੋਰਸ ਵਿੱਚ ਪੜ੍ਹਾਈ ਕਰਦੇ ਹਨ ਮੈਡੀਕਲ ਦੀ ਪੜ੍ਹਾਈ ਕਰਦੇ ਹਨ ਕਈ ਬੱਚੇ ਮਾਸਟਰ ਪੜ੍ਹਾਈ ਪੜ੍ਹਾਈ ਕਰਕੇ ਉਹ ਡਾਕਟਰ ਬਣ ਜਾਂਦੇ ਹਨ ਉਹ ਆਪਣੇ ਹਸਪਤਾਲ ਖੋਲ੍ਹ ਲੈਂਦੇ ਹਨ ਜਾਂ ਕੋਈ ਨਰਸ ਬਣ ਜਾਂਦਾ ਹੈ ਇਸ ਪ੍ਰਕਾਰ ਟੈਕਨੋਲਜੀ ਵਿੱਚ ਕਈ ਪ੍ਰੋਗਰਾਮ ਦਿੱਤੇ ਜਾਂਦੇ ਹਨ ਇਹਨਾਂ ਵਿੱਚ ਕਿੱਤਿਆਂ ਜਾਂ ਕੰਮਾਂ ਕਾਰਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਇਹਨਾਂ ਕੰਮਾਂ ਦੀ ਪੜ੍ਹਾਈ ਕਰਕੇ ਬੱਚਾ ਆਪਣਾ ਕਾਰੋਬਾਰ ਖੋਲ੍ਹ ਲੈਂਦਾ ਹੈ ਅਤੇ ਰੁਜ਼ਗਾਰ ਬਣਾ ਲੈਂਦਾ ਹੈ ਜਿਵੇਂ ਪਸ਼ੂ ਪਾਲਣ ਤਰਖਾਣ ਦਾ ਕੰਮ ਮਿਸਤਰੀ ਦਾ ਕੰਮ ਪਲੰਬਰ ਦਾ ਕੰਮ ਹੋਵੇ ਮੈਥੋਮੈਟਿਕਸ ਵਿੱਚ ਬੱਚੇ ਅਰਥ ਸ਼ਾਸਤਰ ਦੀ ਵਿੱਦਿਆ ਪ੍ਰਾਪਤ ਕਰਕੇ ਵਿੱਤੀ ਪ੍ਰੋਗ ਪ੍ਰੋਗਰਾਮਾਂ ਤੋਂ ਰੁਜ਼ਗਾਰ ਪੈਦਾ ਕਰ ਲੈਂਦੇ ਹਨ